ਸਾਡੇ ਪਿੰਡ ਦੇ ਨੌਜਵਾਨਾਂ ਨੂੰ ਜੋ ਮੋਗਾ ਦੇ ਵਿੱਚ ਨੈਸਲੇ ਡੇਰੀ ਹੈ ਉਸ ਦੇ ਵਿੱਚ ਸੋ ਕੰਮ ਕਰਨ ਦਾ ਜੋ ਸਮਾਂ ਮੌਕਾ ਮਿਲਿਆ ਹੈ ਅਤੇ ਉਹ ਉਹਨਾਂ ਨੂੰ ਉੱਥੇ ਤਨਖਾਹ ਵੀ ਵਧੀਆ ਮਿਲਦੀ ਹੈ ਸੋ ਇਸ ਕਰਕੇ ਉਹ ਬਹੁਤ ਸਾਰੇ ਜੋ ਨੌਜਵਾਨ ਹਨ ਉਸ ਨੈਸਲੇ ਡੇਰੀ ਦੇ ਵਿੱਚ ਕੰਮ ਕਰਨ ਵਾਸਤੇ ਆਉਂਦੇ ਆਉਂਦੇ ਹਨ ਅਤੇ ਉਹਨਾਂ ਨੂੰ ਇਸ ਦੇ ਵਿੱਚੋਂ ਬਹੁਤ ਵਧੀਆ ਤਨਖਾਹ ਮਿਲਦੀ ਹੈ ਸੋ ਆਪਣਾ ਰੁਜ਼ਗਾਰ ਜੋ ਬੜੇ ਵਧੀਆ ਤਰੀਕੇ ਦੇ ਨਾਲ ਆਪਣੇ ਪਰਿਵਾਰਾਂ ਦੀ ਸਾਂਭ ਸੰਭਾਲ ਕਰ ਰਹੇ ਹਨ